ਹੈਲੋ ਹੈਲੋ ਸਤਿ ਸ਼੍ਰੀ ਅਕਾਲ ਜੀ ਅਸੀਂ ਨਾ ਤੁਹਾਡੇ ਨਵੇਂ ਗਵਾਂਢੀ ਆਏ ਹਾਂ ਅਤੇ ਅਸੀਂ ਗੁਜਰਾਤ ਤੋਂ ਇੱਥੇ ਸ਼ਿਫਟ ਕੀਤਾ ਏ ਅਤੇ ਅਸੀਂ ਜਦੋਂ ਦੇ ਪੰਜਾਬ ਆਏ ਅਸੀਂ ਬਹੁਤ ਸਾਰੀਆਂ ਚੀਜ਼ਾਂ ਸੁਣੀਆਂ ਸਿੱਖੀਜ਼ਮ ਬਾਰੇ ਕਿ ਸਿੱਖ ਇੱਦਾਂ ਪੰਜਾਬੀ ਲੋਕ ਇੱਦਾਂ ਦੇ ਹੈ ਅਤੇ ਅਸੀਂ ਵੀ ਚਾਹੁੰਦੇ ਹੈ ਕਿ ਸਾਨੂੰ ਵੀ ਇਸ ਚੀਜ਼ ਬਾਰੇ ਥੋੜ੍ਹੀ ਬਹੁਤੀ ਨੋਲਜ਼ ਹੋਵੇ ਕਿ ਕਿੱਦਾਂ ਏ ਕੀ ਹੋਇਆ ਸੀ ਕੀ ਇਤਿਹਾਸ ਕੀ ਹੈ ਸਿੱਖੀਜ਼ਮ ਦਾ ਅਤੇ ਤੁਸੀਂ ਖੁਦ ਪੰਜਾਬ ਰਹਿੰਦੇ ਹੋ ਪੰਜਾਬੀ ਹੋ ਤੁਸੀਂ ਸਿੱਖ ਰਿਲੀਜਨ ਤੋਂ ਬਿਲੋਂਗ ਕਰਦੇ ਹੋ ਤਾਂ ਜੇ ਤੁਸੀਂ ਸਾਨੂੰ ਥੋੜ੍ਹਾ ਜਿਹਾ ਇਤਿਹਾਸ ਬਾਰੇ ਜਾਣੂ ਕਰ ਸਕਦੇ ਹੋ ਕਿਆ ਅੱਛਾ ਜੀ ਹਾਂਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਅੱਛਾ ਜੀ ਜਿਹੜੇ ਦਸਵੇਂ ਗੁਰੂ ਸੀਗੇ ਠੀਕ ਹੈ ਜੀ ਅੱਛਾ ਜੀ ਠੀਕ ਹੈ ਜੀ ਅੱਛਾ ਜੀ ਅੱਛਾ ਜੀ ਹਾਂਜੀ ਠੀਕ ਹੈ ਜੀ ਜ਼ਰੂਰ ਆਪਾਂ ਕਿਸੇ ਦਿਨ ਫਿਰ ਇਕੱਠੇ ਹੋਵਾਂਗੇ ਮੈਂ ਟਾਈਮ ਕੱਢ ਕੇ ਨਾ ਤੁਹਾਡੇ ਘਰ ਆਵਾਂਗੇ ਅਤੇ ਫਿਰ ਤੁਸੀਂ ਸਾਨੂੰ ਉੱਥੇ ਸਾਰਾ ਕੁਛ ਜ਼ਰੂਰ ਦੱਸ ਦਿਓ ਠੀਕ ਹੈ ਠੀਕ ਹੈ ਜੀ ਓਕੇ ਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ